ਜਦੋਂ ਵੀ ਮੈਂ ਕੋਈ ਸਬਜ਼ੀ ਬਣਾਉਣੀ ਹੁੰਦੀ ਹੈ ਸਭ ਤੋਂ ਪਹਿਲਾਂ ਮੈਂ ਉਸ ਸਬਜ਼ੀ ਨੂੰ ਚੰਗੀ ਤਰ੍ਹਾਂ ਕੱਟਦੀ ਹੈ ਫਿਰ ਧੋਂਦੀ ਹੈ ਅਤੇ ਆਪਣੇ ਜਿੰਨੇ ਵੀ ਮਸਾਲੇ ਮੈਂ ਵਰਤਣ ਕ ਵਰਤੋਂ ਦੇ ਵਿੱਚ ਲਿਆਉਣੇ ਹੈ ਉਹਨਾਂ ਨੂੰ ਇੱਕ ਸਾਇਡ 'ਤੇ ਕੱਢ ਕੇ ਰੱਖਦੀ ਹੈ ਜਿੰਨੀ ਜਿੰਨੀ ਵੀ ਮੈਨੂੰ ਕੁਆਂਟਿਟੀ ਚਾਹੀਦੀ ਹੈ ਸਬਜ਼ੀ ਦੇ ਲਈ ਅਤੇ ਉਨ੍ਹਾਂ ਨੂੰ ਮੈਂ ਹਰ ਇੱਕ ਕਟੋਰੀ ਦੇ ਵਿੱਚ ਛੋਟਾ ਛੋਟਾ ਕਰਕੇ ਰੱਖ ਲੈਂਦੀ ਹੈ ਪਹਿਲਾਂ ਤਾਂ ਜਿੱਦਾਂ ਪਿਆਜ਼ ਸਭ ਤੋਂ ਪਹਿਲਾਂ ਕੱਟ ਲੈਣੇ ਫਿਰ ਟਮਾਟਰ ਫਿਰ ਮਿਰਚ ਇਹ ਸਭ ਕੁਛ ਇਕੱਠਾ ਕਰਕੇ ਰੱਖ ਲੈਣਾ ਫਿਰ ਚੰਗੀ ਤਰ੍ਹਾਂ ਆਪਣੇ ਹੱਥ ਵਗੈਰਾ ਧੋ ਕੇ ਜਿਹੜੇ ਬਰਤਨ ਦੇ ਵਿੱਚ ਖਾਣਾ ਬਣਾਉਣਾ ਉਹਨੂੰ ਚੰਗੀ ਤਰ੍ਹਾਂ ਧੋ ਕੇ ਆਪਣਾ ਤੇਲ ਵਗੈਰਾ ਪਾ ਕੇ ਅਤੇ ਉਹਦੇ ਵਿੱਚ ਆਪਣੇ ਕੜਾਹੀ ਦੇ ਵਿੱਚ ਜਾਂ ਕਿਸੇ ਦੇ ਵਿੱਚ ਜਿਹੜੇ ਵੀ ਬਰਤਨ ਦੇ ਵਿੱਚ ਅਸੀਂ ਖਾਣਾ ਬਣਾ ਰਹੇ ਹਾਂ ਉਹਦੇ ਵਿੱਚ ਤੜਕਾ ਲਗਾ ਕੇ ਆਪਣੀ ਸਬਜ਼ੀ ਨੂੰ ਤਿਆਰ ਕਰ ਲੈਂਦੇ ਹਾਂ